ਸ਼ਹਿਰੀ ਖੇਤਰਾਂ 'ਚ ਪੰਜਾਬ ਦੇ ਮੁਕਾਬਲੇ ਵਿੱਚ ਸਾਖਰਤਾ ਨੂੰ ਕਾਇਮ ਸਿੱਖਿਆ ਦੇ ਤੌਰ 'ਤੇ ਰੱਖਿਆ ਜਾ ਸਕਦਾ ਕਿਉਂਕਿ ਵਧੀਆ ਹੈਗਾ ਜਿਹੜੀ ਤੀ ਪੜ੍ਹਾਈ ਸ਼ੁਰੂ ਕੀਤੀ ਹੈ ਅਨਪੜ੍ਹ ਬੰਦਿਆਂ ਨੂੰ ਵੀ ਐਂ ਪੜ੍ਹਾ ਕੇ ਜਿੰਨਾ ਕੁ ਉਹਨਾਂ ਨੂੰ ਯੋਗਦਾਨ ਪਾਇਆ ਔਰ ਵਧੀਆ ਵਧੀਆ ਹੈਗਾ ਸ਼ਾਖਰਤਾ ਮਿਸ਼ਨ ਹੈ ਜਿਹੜਾ ਬਹੁਤ ਵਧੀਆ ਚੱਲ ਰਿਹਾ ਹੈਗਾ ਅਤੇ ਔਰ ਬਹੁਤ ਹੀ ਵਧੀਆ ਹੈਗਾ ਜਿਹਦੇ ਕਰਕੇ ਲੋਕਾਂ ਨੂੰ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਤਾਂ ਕਿ ਜਿਹੜੇ ਬੰਦੇ ਅਨਨੋਨ ਬੰਦੇ ਆ ਉਹ ਵਧੀਆ ਆਪਦਾ ਆਪਦਾ ਟ੍ਰੇਨਡ ਵਲ ਵਲ ਟਰੇਂਡ ਆਪਣੇ ਆਪ ਨੂੰ ਬਣਾ ਬਣ ਬਣ ਸਕਦੇ ਆ ਜਿਹੜੇ ਗਰੀਬ ਲੋਕ ਜਿਹੜੇ ਨਹੀਂ ਉਹ ਪੜ੍ਹ ਸਕਦੇ ਉਹ ਇਹ ਮਿਸ਼ਨ ਦੇ ਵਿੱਚ ਵੇਖ ਕੇ ਵਿੱਚ ਹਿੱਸਾ ਲੈ ਕੇ ਔਰ ਆਪਣੇ ਆਪ ਨੂੰ ਵਧੀਆ ਜਿਹੜਾ ਜੀਵਨ ਆਪਣਾ ਬਹੁਤ ਵਧੀਆ ਮਾਹੌਲ ਆਪਣਾ ਵਧੀਆ ਬਣਾ ਸਕਦੇ ਹੈ